ਮੈਂ ਗੁਰਦਾਸਪੁਰ ਤੋਂ ਹਰਜੀਤ ਕੌਰ ਬੋਲਦੀ ਪਈ ਹਾਂ ਸਤਿ ਸ਼੍ਰੀ ਅਕਾਲ ਪਸ਼ੂ ਪਾਲਣ ਅਸੀਂ ਆਹ ਘਰ ਵਿੱਚ ਪਸ਼ੂ ਮੱਝਾਂ ਗਾਵਾਂ ਤਾਂ ਰੱਖੀਆਂ ਹੋਈਆਂ ਨੇ ਜਿਹੜਾ ਮਤਲਬ ਕਿ ਪਸ਼ੂ ਪਾਲਣ ਦਾ ਕੰਮ ਕਰਦੇ ਪਏ ਹਾਂ ਉਨ੍ਹਾਂ ਦੀ ਖੁਰਾਕ ਜਿਹੜੀ ਹੈਗੀ ਆ ਉਹ ਵੀ ਅਸੀਂ ਉਨ੍ਹਾਂ ਨੂੰ ਮਤਲਬ ਪਾਲ ਕੇ ਪਸ਼ੂ ਪਾਲਣ ਜਿਹੜਾ ਕੰਮ ਕਿੱਤਾ ਘਰ ਗਾਵਾਂ ਮੱਝਾਂ ਜਿਹੜੀਆਂ ਵਾਂ ਉਹ ਅਸੀਂ ਰੱਖੀਆਂ ਵਾਂ ਉਨ੍ਹਾਂ ਦੀ ਖੁਰਾਕ ਆ ਜਿਵੇਂ ਉਨ੍ਹਾਂ ਨੂੰ ਹਰਾ ਹਰਾ ਬਰਸਨ ਵਗੈਰਾ ਪਾਉਣਾ ਜਾਂ ਚਰੀ ਵਗੈਰਾ ਪਾਉਣੀ ਜਾਂ ਉਨ੍ਹਾਂ ਵਿੱਚ ਵੜੇਵੇਂ ਜਾਂ ਖਲ਼ ਉਨ੍ਹਾਂ ਨੂੰ ਪਾ ਪਾ ਕੇ ਉਨ੍ਹਾਂ ਦਾ ਅਸੀਂ ਪੂਰੀ ਤਰ੍ਹਾਂ ਧਿਆਨ ਰੱਖਦੇ ਹਾਂ ਅਤੇ ਉਹ ਜਿਹੜੀ ਮੀ ਜਿਹੜੀ ਡੇਰੀ ਹੈ ਇੱਕ ਡੇਰੀ ਉਨ੍ਹਾਂ ਦਾ ਦੁੱਧ ਪਾ ਕੇ ਅਸੀਂ ਡੇਰੀ ਡੇਰੀ ਦਾ ਦੁੱਧ ਸਾਡਾ ਜਾਂਦਾ ਵਾ ਉੱਥੇ ਅਸੀਂ ਦੁੱਧ ਜਿਹੜਾ ਉਹ ਵੇਚਦੇ ਹਾਂ ਅਤੇ ਘਰ ਵਿੱਚ ਅਸੀਂ ਮੁਰਗੀਆਂ ਵੀ ਰੱਖੀਆਂ ਹੋਈਆਂ ਨੇ ਉਨ੍ਹਾਂ ਦਾ ਵੀ ਥੋੜ੍ਹਾ ਮਤਲਬ ਕਿ ਉਨ੍ਹਾਂ ਨੂੰ ਥੋੜ੍ਹੇ ਛੋਟੇ ਛੋਟੇ ਲੈ ਕੇ ਬੱਚੇ ਉਨ੍ਹਾਂ ਦੇ ਉਨ੍ਹਾਂ ਨੂੰ ਪਾਲਦੇ ਹਾਂ ਅਤੇ ਪਾਲ ਕੇ ਉਨ੍ਹਾਂ ਨੂੰ ਮਤਲਬ ਕਿ ਪੂਰੀ ਤਰ੍ਹਾਂ ਤਿਆਰ ਕਰਕੇ ਉਹ ਵੀ ਅਸੀਂ ਉਹ ਵੀ ਕੰਮ ਆਪਣੇ ਘਰ ਰੱਖਿਆ ਹੋਇਆ ਵਾ ਅਤੇ ਇਹਦੇ ਖੇਤਰ ਵਿੱਚ ਵੀ ਕਾਫ਼ੀ ਲੋਕ ਸਾਡੇ ਨਾਲ ਜੁੜੇ ਹੋਏ ਨੇ ਸਾਰਾ ਕੰਮ ਕੁਛ ਆਪ ਕਰ ਲਈ ਦਾ ਕੁਛ ਅਸੀਂ ਵਰਕਰ ਰੱਖੇ ਹੋਏ ਉਨ੍ਹਾਂ ਦੇ ਉਨ੍ਹਾਂ ਕੋਲੋਂ ਕੰਮ ਵਗੈਰਾ ਕਰਾ ਲਈ ਦਾ ਵਾ ਅਤੇ ਅਸੀਂ ਆਪਣਾ ਜਿਹੜਾ ਹੈਗਾ ਵਾ ਕਾਰੋਬਾਰ ਸਾਡਾ ਥੋੜ੍ਹਾ ਚੰਗਾ ਚੱਲ ਦਿਆ ਵਾ ਅਤੇ ਜਿਹੜੀ ਮਲ ਗਾਵਾਂ ਮੱਝਾਂ ਦੀ ਖੁਰਾਕ ਜਿਹੜੀ ਹੈ ਉਨ੍ਹਾਂ ਦਾ ਵੀ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਂਦਾ ਵਾ ਹਰ ਕੰਮ ਦੇ ਵਿੱਚ ਉਨ੍ਹਾਂ ਦੇ ਵੱਲ ਵੀ ਹਰ ਚੰਗੀ ਤਰ੍ਹਾਂ ਧਿਆਨ ਕੀਤਾ ਜਾਂਦਾ ਵਾ ਜਾਂ ਜਿਹੜੀ ਹੈਗੀ ਹੈ ਡੇਰੀ ਵਿੱਚ ਅਸੀਂ ਘਰ ਵਿੱਚ ਸਬਜ਼ੀਆਂ ਕਣਕ ਵਗੈਰਾ ਥੋੜ੍ਹੀ ਜ਼ਮੀਨ ਵੀ ਆ ਉਹਦੇ ਵਿੱਚ ਅਸੀਂ ਸਮੇਂ ਦੇ ਹਿਸਾਬ ਨਾਲ ਕਣਕ ਜਾਂ ਚੌਲ ਉਹ ਵੀ ਅਸੀਂ ਲਗਾ ਲੈਂਦੇ ਹਾਂ ਅਤੇ ਜੇ ਕੋਈ ਥੋੜ੍ਹੀ ਬਹੁਤੀ ਜਗ੍ਹਾ ਹੋਵੇ ਬਚ ਜਾਏ ਵਿੱਚ ਸਬਜ਼ੀਆਂ ਵੀ ਲਾ ਲੈਂਦੇ ਹਾਂ ਜਿਹੜੀਆਂ ਸਬਜ਼ੀਆਂ ਵਾ ਉਨ੍ਹਾਂ ਨੂੰ ਵੀ ਅਸੀਂ ਵੇਚ ਕੇ ਆਪਣਾ ਜਿਹੜਾ ਕਾਰੋਬਾਰ ਹੈਗਾ ਉਹ ਅਸੀਂ ਵਧਾਇਆ ਵਾ ਅਤੇ ਇਸ ਕਰਕੇ ਕੋਈ ਨਾ ਕੋਈ ਕੰਮ ਅਸੀਂ ਮਤਲਬ ਕਿ ਕਰਦੇ ਹੀ ਰਹਿੰਦੇ ਹਾਂ ਘਰ ਵਿੱਚ ਅਤੇ ਪਸ਼ੂ ਪਾਲਣ ਦਾ ਜ਼ਿਆਦਾ ਖਾਸ ਕਰਕੇ ਧਿਆਨ ਉਨ੍ਹਾਂ ਵਾਸਤੇ ਰੱਖਿਆ ਜਾਂਦਾ ਵਾ ਵੀ ਚਲੋ ਇਨ੍ਹਾਂ ਵਾਸਤੇ ਖਲ਼ ਵੜੇਵੇਂ ਜੋ ਵੀ ਸਾਡੇ ਕੋੋਲੋਂ ਹੁੰਦਾ ਵਾ ਓਨਾ ਕੁ ਉਨ੍ਹਾਂ ਦਾ ਹੀ ਕਰੀ ਜਾਂਦੇ ਹਾਂ ਸਾਰਾ ਕੁਛ ਇਸ ਲਈ ਅਸੀਂ ਕਾਰੋਬਾਰ ਆਪਣਾ ਚਲਾਈ ਜਾਂਦੇ